ਭਾਰਤ ਦੇ ਬਹੁਤ ਸਾਰੇ ਪ੍ਰਸਿੱਧ ਵਿਗਿਆਨੀ ਹਨ ਜਿਵੇਂ ਕਿ ਆਰੀਆਭੱਟ ਏ ਪੀ ਜੇ ਅਬਦੁਲ ਕਲਾਮ ਸਲੀਮ ਅਲੀ ਚੰਦਰ ਬੋਸ ਹਰਗੋਬਿੰਦ ਖੁਰਾਨਾ ਸੀ ਵੀ ਰਮਨ ਮੇਰਾ ਮਨਪਸੰਦ ਵਿਗਿਆਨੀ ਏ ਪੀ ਜੇ ਅਬਦੁਲ ਕਲਾਮ ਹੈ ਜੋ ਕਿ ਭਾਰਤ ਦਾ ਗਿਆਰ੍ਹਵਾਂ ਪ੍ਰਧਾਨ ਮੰਤਰੀ ਵੀ ਰਹਿ ਸਕਿਆ ਹੈ ਇਸ ਨੇ ਮਿਸਾਈਲ ਦੀ ਖੋਜ ਕੀਤੀ ਸੀ